ਪਸ਼ੂਆਂ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਦਿਨ ਚਰਿਆ ਦੀ ਰੁਟੀਨ ਆ ਸਭ ਤੋਂ ਪਹਿਲਾਂ ਸਵੇਰੇ ਚਾਰ ਵਜੇ ਉੱਠੀਦਾ ਅਤੇ ਪਸ਼ੂਆਂ ਨੂੰ ਨਹਿਲਾਈ ਦਾ ਧੁਲਾਈਦਾ ਅਤੇ ਪਸ਼ੂਆਂ ਲਈ ਪੱਠੇ ਵੱਢੀਦੇ ਪੱਠੇ ਵੱਢਣ ਤੋਂ ਬਾਅਦ ਉਹਨਾਂ ਨੂੰ ਟਰਾਲੀ ਦੇ ਵਿੱਚ ਵਿਛਾ ਦਈਦਾ ਉੱਗਦੇ ਕਾਰਨ ਜਿਹੜੇ ਪਸ਼ੂ ਹੁੰਦੇ ਨੇ ਉਹ ਭੁੱਖੇ ਹੁੰਦੇ ਨੇ ਰਾਤ ਦੇ ਅਤੇ ਉਹ ਚਰਦੇ ਰਹਿੰਦੇ ਨੇ ਉਹਨਾਂ ਤੋਂ ਬਾਅਦ ਅਸੀਂ ਸਵੇਰੇ ਉਸ ਤੋਂ ਬਾਅਦ ਦੁੱਧ ਚੋਇਆ ਜਾਂਦਾ ਹੈ ਉਹਨਾਂ ਨੂੰ ਨਹਿਲਾ ਤੁਲਾ ਤੋਂ ਬਾਅਦ ਉਸ ਤੋਂ ਬਾਅਦ ਦੁਪਹਿਰ ਸ਼ਾਮ ਦਾ ਵੇਲਾ ਆ ਜਾਂਦਾ ਫਿਰ ਦੁਬਾਰਾ ਸ਼ਾਮ ਨੂੰ ਦੁੱਧ ਚੋਇਆ ਜਾਂਦਾ ਪੱਠੇ ਪਾਈ ਜਾਂਦੇ ਆ ਉਹਨੂੰ ਰੂੜੀਆਂ ਦਿੱਤੀਆਂ ਜਾਂਦੀਆਂ ਨੇ ਪਸ਼ੂਆਂ ਨੂੰ ਪ੍ਰੋਟੀਨ ਦਿੱਤਾ ਜਾਂਦਾ ਜਿਹਦੇ ਕਾਰਨ ਉਹ ਹਸਤ ਪੁਸ਼ਟ ਰਹਿਣ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਰਾਤ ਨੂੰ ਵੀ ਉਹ ਇਸੇ ਤਰ੍ਹਾਂ ਹੀ ਸਾਫ ਸੁਥਰੇ ਹੋ ਕੇ ਉਹਨਾਂ ਨੂੰ ਨਹਲਾ ਧੁਲਾ ਕੇ ਜਾਂ ਖੱਲ੍ਹ ਵੜੇਵੇ ਵੀ ਪਾਏ ਜਾਂਦੇ ਹਨ ਜਿਹਨਾਂ ਨਾਲ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਪਸ਼ੂਆਂ ਨੂੰ ਜਿਹਨਾਂ ਨਾਲ ਬਿਮਾਰ ਨਹੀਂ ਪੈਂਦੇ ਘੱਟ ਪੈਂਦੇ ਨੇ ਇਸੇ ਤਰ੍ਹਾਂ ਹੀ ਇਹ ਰੂਟੀਨ ਦਿਨ ਚਰਿਆ ਦੀ ਚਲਦੀ ਰਹਿੰਦੀ ਹੈ ਹਰ ਰੋਜ਼ ਇਹੀ ਰੂਟੀਨ ਹੁੰਦੀ ਹੈ ਜਿਹਦੇ ਕਾਰਨ ਪਸ਼ੂ ਵੀ ਸਹੀ ਰਹਿੰਦੇ ਨੇ ਅਤੇ ਵਧੀਆ ਵੀ ਰਹਿੰਦੇ ਨੇ